ਰਫਲ ਬਲੈਕ ਕਰੰਟ ਵਾਈਟ ਚੋਕਲੇਟ ਪੀਜਾ ਬਰਗਰ ਸੂਸ਼ੀ ਸਟੀਕ ਬੈਫਲਜ਼ ਡੋਨਟਸ ਟੈਕੋਜ਼ ਟੂਨਾ ਮੋਫੀਨ ਟਰਕੀ ਟੋਫੂ ਰੀਸੋਟੋ ਕੁਇਸ਼ੀ ਫਲੈਫਲ ਫਰਾਈਜ ਜਾਵਾ ਪਲਮ ਬੀਨਸ ਬਰੋਡ ਬੀਨਸ ਸ਼ਿੱਕ ਪੀਸ ਕਿਡਨੀ ਬੀਨਸ ਪੀਸ